ਹਾਂਜੀ ਮੇਰੇ ਨੇੜੇ ਬਹੁਤ ਤਰ੍ਹਾਂ ਦੇ ਖੇਤਰ ਨੇ ਜੋ ਕਿ ਆਪਣੀ ਸੁੰਦਰਤਾ ਲਈ ਬਹੁਤ ਜ਼ਿਆਦਾ ਮਸ਼ਹੂਰ ਨੇ ਇੱਕ ਪਹਿਲਾਂ ਤਾਂ ਚੰਡੀਗੜ੍ਹ ਅਤੇ ਦੂਜਾ ਹਿਮਾਚਲ ਚੰਡੀਗੜ੍ਹ ਵਿੱਚ ਬਹੁਤ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਜਗ੍ਹਾ ਹਨ ਜਿੱਥੇ ਕਿ ਲੋਕਲ ਅਤੇ ਦੂਰ ਦੁਰਾਡੇ ਤੋਂ ਆਏ ਲੋਕ ਘੁੰਮ ਸਕਦੇ ਹਨ ਪਹਿਲਾਂ ਤਾਂ ਰੌਕ ਗਾਰਡਨ ਦੂਜਾ ਰੋਜ਼ ਗਾਰਡਨ ਅਤੇ ਤੀਜੀ ਸੁਖਨਾ ਝੀਲ ਰੋਕ ਗਾਰਡਨ ਦੇ ਵਿੱਚ ਬ ਅਲੱਗ ਅਲੱਗ ਤਰ੍ਹਾਂ ਦੀਆਂ ਮੂਰਤਾਂ ਹਨ ਜੋ ਕਿ ਵੇਸਟੇਜ ਤੋਂ ਬਣੀਆਂ ਹੋਈਆਂ ਹਨ ਅਤੇ ਰੋਜ਼ ਗਾਰਡਨ ਵਿੱਚ ਲਗਭਗ ਚੌਦਾਂ ਸੌ ਤੋਂ ਵੱਧ ਰੋਜ਼ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ ਅਤੇ ਜਿੱਥੇ ਕਿ ਲੋਕ ਘੁੰਮ ਫਿਰ ਸਕਦੇ ਹਨ ਅਤੇ ਬਹੁਤ ਤਰ੍ਹਾਂ ਦੀਆਂ ਅਲੱਗ ਅਲੱਗ ਫੋਟੋਗ੍ਰਾਫ ਦਾ ਆਨੰਦ ਮਾਣ ਸਕਦੇ ਹਨ ਇਸ ਤੋਂ ਇਲਾਵਾ ਸੁਖਨਾ ਝੀਲ ਸੁਖਨਾ ਝੀਲ ਵਿੱਚ ਬਹੁਤ ਇਹ ਵੀ ਮੱਧਕਾਲੀਨ ਤੋਂ ਇੱਥੇ ਪਹਾੜਾਂ ਇੱਥੇ ਜੰਗਲਾਂ ਜੰਗਲ ਸਨ ਜਿੱਥੇ ਕਿ ਹਾਥੀ ਟਹਿਲਿਆ ਕਰਦੇ ਸਨ ਅਤੇ ਉਹਨਾਂ ਦੇ ਦੰਦ ਨੂੰ ਅਜਾਇਬ ਘਰ ਦੇ ਵਿੱਚ ਸੰਭਾਲਿਆ ਗਿਆ ਹੈ ਅਤੇ ਜੋ ਜਦੋਂ ਆਪਾਂ ਹਿਮਾਚਲ ਦੀ ਗੱਲ ਕਰਦੇ ਹਾਂ ਤਾਂ ਇਹ ਪਹਾੜੀ ਖੇਤਰ ਆ ਜਾਂਦਾ ਹੈ ਜਿਵੇਂ ਕਿ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਖੇਤੇ ਖੇਤਰ ਹਨ ਅਤੇ ਜੋ ਕਿ ਬੋ ਘੁੰਮਣ ਫਿਰਨ ਲਈ ਬਹੁਤ ਜ਼ਿਆਦਾ ਮਸ਼ਹੂਰ ਹਨ